ਹੈਲੋ ਹਾਂਜੀ ਹਾਂਜੀ ਹਾਂਜੀ ਤੁਸੀਂ ਕੋਣ ਜੀ ਹਾਂਜੀ ਮੈਡਮ ਦੱਸੋ ਜੀ ਮੈਂ ਤੁਹਾਡੀ ਕੀ ਹੈਲਪ ਕਰ ਸਕਦੀ ਹਾਂ ਹਾਂਜੀ ਪਹਿਲਾਂ ਤਾਂ ਜੀ ਮੋ ਮੋਸਟ ਵੈਲਕਮ ਤੁਸੀਂ ਆਪਣੇ ਬੱਚੇ ਨੂੰ ਲੈ ਕੇ ਆਓ ਇੱਥੇ ਜਿਹੜਾ ਸਾਡਾ ਕਲੱਬ ਹੈ ਜੀ ਉਹ ਬਹੁਤ ਸਾਰੀਆਂ ਐਕਟੀਵੀਟਿਜ਼ ਕਰਾਉਂਦਾ ਬੱਚਿਆਂ ਦੀਆਂ ਜਿਵੇਂ ਕਿ ਪੇਂਟਿੰਗ ਹੋ ਗਈ ਡਰਾਇੰਗ ਹੋ ਗਈ ਕਿਉਜ਼ ਹੋ ਗਏ ਉਸ ਤੋਂ ਬਾਅਦ ਜਿਹੜੇ ਬੱਚਿਆਂ ਨੂੰ ਯੋਗਾ 'ਚ ਇੰਟਰੱਸਟ ਹੈ ਜਾਂ ਸਵੀਮਿੰਗ 'ਚ ਇੰਟਰੱਸਟ ਹੈ ਤਾਂ ਉਹ ਵੀ ਕਰਦੇ ਨੇ

ਹਾਂਜੀ ਹਾਂਜੀ ਮੈਮ ਡਾਂਸ ਦਾ ਵੀ ਹੈ ਸਵੇਰੇ ਜੀ ਸਵੇਰੇ ਨੌ ਤੋਂ ਲੈ ਕੇ ਗਿਆਰਾਂ ਤੱਕ ਹੈ ਅਤੇ ਸ਼ਾਮੀ ਚਾਰ ਤੋਂ ਲੈ ਕੇ ਛੇ ਵਜੇ ਤੱਕ ਦੀ ਟਾਈਮਿੰਗ ਹੈ ਜੀ ਜਿਵੇਂ ਜਿਵੇਂ ਬੱਚੇ ਦਾ ਇੰਟਰੱਸਟ ਹੁੰਦਾ ਅਸੀਂ ਉੱਦਾਂ ਉੱਦਾਂ ਉਹਨੂੰ ਉੱਦਾਂ ਦੀਆਂ ਐਕਟੀਵੀਟਿਜ਼ ਕਰਾਉਂਦੇ ਹੈ ਜੀ ਅਸੀਂ ਕੋਈ ਇਨ੍ਹਾਂ 'ਤੇ ਜ਼ੋਰ ਜਾਂ ਕੋਈ ਦਬਾਅ ਨਹੀਂ ਪਾਉਂਦੇ ਜਿਹੜੇ ਤਾਂ ਬੱਚੇ ਜੀ ਛੇ ਤੋਂ ਲੈ ਕੇ ਪੰਦਰਾਂ ਸਾਲ ਤੱਕ ਦੇ ਹੈ ਉਹਨਾਂ ਤੋਂ ਅਸੀਂ ਦੋ ਸੌ ਰੁਪਇਆ ਰਜਿਸਟ੍ਰੇਸ਼ਨ ਫ਼ੀਸ ਰੱਖੀ ਹੋਈ ਹੈ ਜਿਹੜੇ ਅਠਾਰ੍ਹਾਂ ਤੋਂ ਲੈ ਕੇ ਬਾਈ ਸਾਲ ਦੇ ਬੱਚੇ ਨੇ ਉਹਨਾਂ ਦੀ ਅਸੀਂ ਫ਼ੀਸ ਰੱਖੀ ਹੋਈ ਹੈ ਜੀ ਰਜਿਸਟ੍ਰੇਸ਼ਨ ਪੰਜ ਸੌ ਰੁਪਇਆ ਫਿਰ ਜੀ ਤੁਹਾਨੂੰ ਮੈਬਰਸ਼ਿਪ ਮਿਲ ਜਾਂਦੀ ਹੈ ਉਸ ਮੈਬਰਸ਼ਿਪ 'ਚ ਤੁਸੀਂ ਸਾਲ ਬਾਅਦ ਛੇ ਸੌ ਰੁਪਇਆ ਦੇਣਾ ਹੁੰਦਾ ਹੈ ਜੀ ਸਾਰਿਆਂ ਨੇ ਹਾਂਜੀ ਹਾਂਜੀ ਮੈਮ ਤੁਸੀਂ ਵੈਸੇ ਇਕ ਵਾਰੀ ਸਾਡੇ ਆਫਿਸ ਵੀ ਆ ਜਿਓ ਜੀ ਫਿਰ ਤੁਹਾਨੂੰ ਪਤਾ ਲੱਗ ਜੂੰਗਾ ਜੀ ਸਾਰਾ ਕੁਛ ਹਾਂਜੀ ਹਾਂਜੀ ਮੈਮ ਮੋਸਟ ਵੈਲਕਮ ਤੁਸੀਂ ਕਦੇ ਵੀ ਆ ਸਕਦੇ ਹੋ ਜੀ ਆਫਿਸ ਸਾਡਾ ਨੌ ਤੋਂ ਲੈ ਕੇ ਪੰਜ ਤੱਕ ਖੁੱਲ੍ਹਾ ਹੀ ਹੁੰਦਾ ਹੈ ਜੀ ਤੁਸੀਂ ਆ ਕੇ ਵਿਜ਼ਿਟ ਕਰ ਲੋ ਉਹਨਾਂ ਤੋਂ ਸਾਰੀ ਜਾਣਕਾਰੀ ਲੈ ਲੋ ਵੈਸੇ ਤਾਂ ਸਾਰਾ ਕੁਛ ਤੁਹਾਨੂੰ ਮੈਂ ਦੱਸ ਹੀ ਦਿੱਤਾ ਹੈ ਬਾਕੀ ਤੁਸੀਂ ਆਫਿਸ ਆ ਕੇ ਵੀ ਪਤਾ ਕਰ ਲਿਓ ਜੀ ਮੋਸਟ ਵੈਲਕਮ ਆ